ਯੋਗੇ ਦੇ ਨਾਲ ਖੂਨ ਦੀ ਛਮਤਾ ਵੱਧਦੀ ਹੈ ਯੋਗੇ ਦੇ ਨਾਲ ਹੀ ਸਾਰੇ ਦਵਾਈਆਂ ਅਤੇ ਹਰ ਇੱਕ ਨੈਗੇਟਿਵ ਇਫੈਕਟ ਜਿਹੜਾ ਹੈ ਗਲਤ ਪ੍ਰਭਾਵ ਜਿਹੜਾ ਉਹ ਸਾਡੇ ਸਰੀਰ ਤੋਂ ਬਾਹਰ ਹੋ ਜਾਂਦਾ ਜਿਵੇਂ ਕਿ ਸਾਡੇ ਪੇਟ ਦੀਆਂ ਪੇਟ ਦੀਆਂ ਦਰਦਾਂ ਲੱਕ ਪੀੜ ਅੱਖਾਂ ਨੂੰ ਦਰਦ ਬਰੇਨ ਦੇ ਵਿੱਚ ਖੂਨ ਦਾ ਘੱਟ ਪਹੁੰਚਣਾ ਅਤੇ ਅਪ ਹਰ ਇੱਕ ਤਰੀਕੇ ਦੀ ਨੈਗ ਗਲਤ ਪ੍ਰਭਾਵ ਨੂੰ ਇਹ ਘੱਟ ਕਰਦਾ ਹੈ ਇਸ ਨਾਲ ਸਾਡੇ ਹਰ ਇੱਕ ਅੰਗ ਨੂੰ ਖੂਨ ਦੀ ਮਾਤਰਾ ਆਕਸੀਜਨ ਦੀ ਮਾਤਰਾ ਵੀ ਵੱਧ ਜਾਂਦੀ ਹੈ ਇਸ ਨਾਲ ਸਾਡੇ ਸਰੀਰ ਦੇ ਵਿੱਚ ਇੱਕ ਨਵੀਂ ਹੀ ਊਰਜਾ ਹੁੰਦੀ ਹੈ ਜਿਹਦੇ ਕਰਕੇ ਅਸੀਂ ਸਾਰੇ ਕੰਮ ਬਹੁਤ ਹੀ ਜ਼ਿਆਦਾ ਤੀਬਰਤਾ ਚੰਗੇ ਤਰੀਕੇ ਨਾਲ ਕਰਦੇ ਹਾਂ ਖੂਨ ਦੀ ਮਾਤਰਾ ਵਧਣ ਕਰਕੇ ਨਵੇਂ ਸੈਲ ਸਾਡੇ ਜਿਹੜੇ ਸਰੀਰ ਦੇ ਵਿੱਚ ਖੂਨ ਦੇ ਨਵੇਂ ਸੈੱਲ ਬਣਨੇ ਘੱਟ ਹੁੰਦੇ ਹਨ ਉਹ ਵੀ ਵੱਧ ਜਾਂਦੇ ਹਨ ਅਤੇ ਜਿਹੜੇ ਸਾਡੇ ਸਰੀਰ ਦੇ ਵਿੱਚ ਵੱਡੀ ਤੋਂ ਵੱਡੀ ਬਿਮਾਰੀਆਂ ਵਾਲੇ ਵੀ ਸੈੱਲ ਹਨ ਉਹ ਵੀ ਘੱਟ ਜਾਂਦੇ ਹਨ ਜਿਹਦੇ ਕਰਕੇ ਸਾਨੂੰ ਕੋਈ ਵੱਡੀ ਬਿਮਾਰੀ ਹੋਣ ਦੇ ਚਾਂਸਿਸ ਜਾਂ ਫਿਰ ਕਹਿ ਸਕਦੇ ਹਾਂ ਕਿ ਗਲਤ ਚੀਜ਼ਾਂ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਚੰਗੀ ਚੀਜ਼ਾਂ ਦੀ ਮਾਤਰਾ ਵੱਧ ਜਾਂਦੀ ਹੈ ਇਸ ਕਰਕੇ ਸਾਨੂੰ ਯੋਗਾ ਕਰਨਾ ਚਾਹੀਦਾ ਹੈ ਇਸ ਦੇ ਨਾਲ ਸਾਡੇ ਸਰੀਰ ਦੇ ਵਿੱਚ ਕੋਈ ਵੀ ਪਰੋ ਕੋਈ ਵੀ ਗਲਤ ਪ੍ਰਭਾਵ ਨਹੀਂ ਪਵੇਗਾ ਅਤੇ ਸਾਡੇ ਸ਼ ਹਰ ਇੱਕ ਚੀਜ਼ ਇੱਥੋਂ ਤੱਕ ਕਿ ਸਾਡੇ ਅੱਖਾਂ ਜਿਹੜੀਆਂ ਇੰਨੀਆਂ ਨਾਜ਼ੁਕ ਹੁੰਦੀਆਂ ਹਨ ਉਹ ਵੀ ਇੱਕ ਨਵੀਂ ਹੀ ਊਰਜਾ ਦੇ ਨਾਲ ਆਉਂਦੀਆਂ ਹਨ ਸਾਡੇ ਸ ਅੱਖਾਂ ਦੀ ਰੋਸ਼ਨੀ ਵੱਧ ਜਾਂਦੀ ਹੈ ਸਾਡੇ ਖਾਣ ਪੀਣ ਦੀ ਸ਼ਕਤੀ ਵੱਧ ਜਾਂਦੀ ਹੈ ਜਿੱਥੇ ਅਸੀਂ ਆਪਣੇ ਆਪ ਨੂੰ ਅਤੇ ਹੋਰ ਦੀ ਗੱਲਾਂ ਨੂੰ ਸੁਣ ਨਹੀਂ ਸਕਦੇ ਉੱਥੇ ਸਾਡੇ ਕੰਨ ਦੀ ਸ਼ਕਤੀ ਵੀ ਵੱਧਦੀਆਂ ਹੈ ਸਾਡੇ ਹਰ ਇੱਕ ਚੀਜ਼ ਤਰੀਕੇ ਨਾਲ ਹੁੰਦੀ ਹੈ ਹਰ ਇੱਕ ਰੋਗ ਤੋਂ ਬਚਣ ਦੀ ਛਮਤਾ ਵੱਧਦੀ ਹੈ